ਮੇਰੇ ਦੁਆਰਾ ਪੜ੍ਹੀ ਗਈ ਆਖਰੀ ਕਿਤਾਬ ਦਾ ਨਾਂ ਸੀ ਪੰਜਾਬ ਦੀਆਂ ਫਸਲਾਂ ਜਿਸਨੇ ਮੈਨੂੰ ਅਸਲ ਵਿੱਚ ਬਹੁਤ ਪ੍ਰਭਾਵਿਤ ਕੀਤਾ ਅਤੇ ਮੈਨੂੰ ਬਹੁਤ ਹੀ ਵਧੀਆ ਲੱਗੀ ਇਸ ਵਿੱਚ ਪੰਜਾਬ ਨੂੰ ਦੇਸ਼ ਦਾ ਅੰਨ ਭੰਡਾਰ ਮੰਨਿਆ ਜਾਂਦਾ ਹੈ ਇਹ ਕਿੱਤਾ ਸੰਸਾਰ ਦੇ ਉਹਨਾਂ ਕੁਝ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਮਨੁੱਖੀ ਸੱਭਿਅਤਾ ਦਾ ਵਿਕਾਸ ਹੋਇਆ ਅਤੇ ਖੇਤੀ ਨੇ ਜਨਮ ਲਿਆ ਪੰਜਾਬ ਵਿੱਚ ਹੁਣ ਵੀ ਸੂਬੇ ਦੀ ਆਮਦਨ ਵਿੱਚ ਖੇਤੀ ਦਾ ਯੋਗਦਾਨ ਚੁਤਾਲੀ ਪ੍ਰਤੀਸ਼ਤ ਹੈ ਜਦੋਂ ਕਿ ਦੇਸ਼ ਦੀ ਇਹ ਦਰ ਪੱਚੀ ਪ੍ਰਤੀਸ਼ਤ ਹੈ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਖੇਤੀ ਨੂੰ ਸਭ ਤੋਂ ਉੱਤਮ ਧੰਦਾ ਮੰਨਿਆ ਜਾਂਦਾ ਹੈ ਜਿਸ ਤੇਜ਼ੀ ਨਾਲ ਪੰਜਾਬੀ ਕਿਸਾਨ ਨਵੀਆਂ ਫਸਲਾਂ ਅਤੇ ਨਵੀਂ ਟੈਕਨੀਕ ਅਪਣਾਉਂਦਾ ਹੈ ਸ਼ਾਇਦ ਇੰਨੀ ਤੇਜ਼ੀ ਨਾਲ ਇਹ ਕਿਧਰੇ ਨਹੀਂ ਹੁੰਦਾ ਪੰਜਾਬੀ ਹਿੰਮਤ ਅਤੇ ਦਲੇਰੀ ਨਾਲ ਔਕੜਾਂ ਆਫਤਾਂ ਅਤੇ ਮੁਸ਼ਕਲਾਂ ਦਾ ਮੁਕਾਬਲਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਕਰਦੇ ਹਨ ਅਤੇ ਅਗਾਂਹ ਵੱਧਦੇ ਹਨ ਮੌਜੂਦਾ ਪੁਸਤਕ ਵਿੱਚ ਪੰਜਾਬ ਦੀ ਖੇਤੀ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਦੀ ਇੱਕ ਝਲਕ ਪੇਸ਼ ਕਰਨ ਦਾ ਬਹੁਤ ਵੱਡਾ ਅਤੇ ਪੁਰਾਣਾ ਯਤਨ ਕੀਤਾ ਗਿਆ ਸੀ ਡਾਕਟਰ ਰਣਜੀਤ ਸਿੰਘ ਨੇ ਖੇਤੀ ਦੇ ਵਿਗਿਆਨੀ ਸਨ ਪੇਂਡੂ ਅਤੇ ਖੇਤੀ ਵਿਕਾਸ ਦੇ ਉਹ ਮਾਹਰ ਸਨ ਖੇਤੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਨਵੀਆਂ ਤਕਨੀਕਾਂ ਵਿਕਸਿਤ ਕਰਨ ਵਿੱਚ ਉਹਨਾਂ ਨੂੰ ਵਿਸ਼ੇਸ਼ ਉਹਨਾਂ ਨੇ ਵਿਸ਼ੇਸ਼ ਖੋਜ ਕੀਤੀ ਉਹਨਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐੱਚ ਡੀ ਅਤੇ ਅਮਰੀਕਾ ਦੀ ਕਾਰਨੀਲ ਯੂਨੀਵਰਸਿਟੀ ਤੋਂ ਸੰਸਾਰ ਯੋਜਨਾਬੰਦੀ ਦੀ ਵਿਕਾਸ ਸਿਖਲਾਈ ਪ੍ਰਾਪਤ ਕੀਤੀ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਹੀ ਪ੍ਰੋਫੈਸਰ ਪਸਾਰ ਸਿੱਖਿਆ ਸੰਸਾਰ ਕੇਂਦਰ ਅਤੇ ਡੀਨ ਖੇਤੀਬਾੜੀ ਕਾਲਜ ਵਿੱਚ ਵੀ ਪੜ੍ਹੇ ਵੀਹ ਤੋਂ ਵੱਧ ਪੁਸਤਕਾਂ ਦੇ ਰਚੇਤਾ ਸੱਠ ਖੋਜ ਪੱਤਰ ਛੇ ਸੌ ਲੱਖ ਪ੍ਰਕਾਸ਼ਿਤ ਹੋ ਚੁੱਕੇ ਹਨ ਉਹਨਾਂ ਦੀਆਂ ਅੱਠ ਪੁਸਤਕਾਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਇਨਾਮ ਵੀ ਮਿਲ ਚੁੱਕੇ ਹਨ ਇਸ ਪੁਸਤਕ ਨੂੰ ਪੜ੍ਹ ਕੇ ਮੈਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਬਹੁਤ ਕੁਝ ਪੰਜਾਬ ਦੀਆਂ ਫਸਲਾਂ ਬਾਰੇ ਵੀ ਜਾਣਕਾਰੀ ਉਹਨਾਂ ਦੇ ਕਿੱਤੇ ਕੰਮਾਂ ਕਿਹੜੇ ਕਿਹੜੇ ਮਹਾ ਮਹਾਨ ਪੁਸਤਕ ਲਿਖੀਆਂ ਗਈਆਂ ਸਾਰਿਆਂ ਬਾਰੇ ਜਾਣਕਾਰੀ ਮਿਲੀ